ਅੱਜ ਕੱਲ੍ਹ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਯੁੱਗ ਇੰਟਰਨੈੱਟ ਦਾ ਯੁੱਗ ਹੈ ਅਤੇ ਮੇਰੇ ਪਿੰਡ ਦੇ ਬਹੁਤ ਸਾਰੇ ਨੌਜਵਾਨ ਇੰਟਰਨੈੱਟ ਦੀ ਮਦਦ ਦੇ ਨਾਲ ਵੱਖ ਵੱਖ ਡਾਂਸ ਸਟੇਜਾਂ 'ਤੇ ਪਹੁੰਚੇ ਹਨ ਜਿਵੇਂ ਕਿ ਮੈਂ ਵੀ ਜੁੜੀ ਹਾਂ ਡਾਂਸ ਫਾਰਮਾਂ ਦੇ ਨਾਲ ਜੁੜਨ ਦੇ ਨਾਲ ਉਹ ਆਪਣਾ ਅੰਦਰਲਾ ਟੈਲੈਂਟ ਦੂਜਿਆਂ ਨੂੰ ਦਿਖਾਉਂਦੇ ਹਨ ਜਿਸ ਕਾਰਨ ਉਹ ਹੋਰ ਵੀ ਵੱਧ ਖੁਸ਼ ਹੁੰਦੇ ਹਨ ਅਤੇ ਸਫਲਤਾ ਪ੍ਰਾਪਤ ਕਰਦੇ ਹਨ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਅਸੀਂ ਅਲੱਗ ਅਲੱਗ ਡਾਂਸ ਫਾਰਮਾਂ ਵਿੱਚ ਜੁੜਦੇ ਹਾਂ ਤਾਂ ਇਹ ਸਾਡੀਆਂ ਅੰਦਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਮਾਰਦੇ ਹੋਏ ਸਾਡਾ ਅੰਦਰਲਾ ਟੈਲੈਂਟ ਦੂਜਿਆਂ ਸਾਹਮਣੇ ਹੋਰ ਨਿਖਾਰਦਾ ਹੈ